ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂ ਤੁਹਾਡਾ ਕੀ ਨਾਂ ਹੈ ਠੀਕ ਹੈ ਇਹ ਕਿੱਥੋਂ ਆਏ ਤੁਸੀਂ ਓਕੇ ਹੁਸ਼ਿਆਰ ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਮੈਂ ਤੁਹਾਨੂੰ ਦੱਸਦਾਂ ਕਾਫ਼ੀ ਦੇਰ ਤੋਂ ਮੈਂ ਤਾਂ ਹੁਸ਼ਿਆਰਪੁਰ 'ਚ ਹੀ ਰਹਿ ਰਿਹਾ ਹੁਸ਼ਿਆਰਪੁਰ ਦਾ ਕਲਾਈਮੇਟ ਪਹਿਲਾਂ ਤੋਂ ਹੀ ਕਾਫ਼ੀ ਵਧੀਆ ਰਿਹਾ ਥੋੜ੍ਹੇ ਸਮੇਂ ਤੋਂ ਜਦੋਂ ਤੋਂ ਟਰੈਫਿਕ ਜ਼ਿਆਦਾ ਹੋ ਗਈ ਕਰਕੇ ਜਾਂ ਆਪਾਂ ਕਹਿ ਲਈਏ ਘਰਾਂ 'ਚ ਇਲੈਕਟਰਿਕ ਚੀਜ਼ਾਂ ਦੀ ਯੂਜਜ ਵਧ ਗਈ ਹੈ ਉਸ ਕਾਰਨ ਕਰੋਲੋਫਲੋਰੋੋਕਾਰਬਨਸ ਵਧ ਗਏ ਹੈ ਤਾਂ ਹੋਰ ਗਲੋਬਲ ਵਾਰਮਿੰਗ ਦਾ ਵੀ ਅਸਰ ਹੋ ਰਿਹਾ ਇਸ ਕਰਕੇ ਇੰਪੈਕਟ ਪੈ ਰਿਹਾ ਬਹੁਤ ਵੈਸੇ ਹੁਸ਼ਿਆਰਪੁਰ ਦਾ ਕਲਾਈਮੇਟ ਜੇ ਬਾਕੀ ਜਿਲ੍ਹਿਆਂ ਨਾਲ ਕੰਪੇਅਰ ਕੀਤਾ ਜਾਵੇ ਤਾਂ ਸਭ ਤੋਂ ਵਧੀਆ ਹੈ ਹਜੇ ਵੀ

ਇਹ ਵੀ ਆ ਅਤੇ ਥੋੜ੍ਹਾ ਤੁਹਾਡਾ ਐਰਿਡ ਜੋਨ ਕਰਕੇ ਤੁਹਾਨੂੰ ਇੱਧਰ ਆ ਕੇ ਤਾਂ ਜ਼ਿਆਦਾ ਫੀਲ ਹੋ ਰਿਹਾ ਸਡਨ ਕਿ ਸਡਨ ਚੇਂਜਜ ਜਿਹੜੇ ਹੋ ਰਹੇ ਨੇ ਸਾਨੂੰ ਪਹਾੜ ਵੀ ਨਾਲ ਲੱਗਦੇ ਨੇ ਹਿਮਾਚਲ ਨਾਲ ਲੱਗਦਾ ਹੈ ਇਸ ਕਰਕੇ ਹੈ ਨਾ ਪਹਾੜੀ ਖੇਤਰ ਹੋ ਕਰਕੇ ਉਹਦੇ ਕਾਰਨ ਜਿਹੜੇ ਬਦਲਾਅ ਆ ਇਸ ਕਲਾਈਮੇਟ 'ਚ ਉਹ ਸਡਨ ਹੋ ਜਾਂਦੇ ਨੇ ਇਕਦਮ ਤਾਂ ਹੀ ਆਉਂਦੇ ਨੇ ਹਾਂਜੀ ਉਹ ਤਾਂ ਹੀ ਕਰਕੇ ਹੈ ਵੈਸੇ ਤਾਂ ਹੁਸ਼ਿਆਰਪੁਰ ਸਭ ਤੋਂ ਵਧੀਆ ਹੈਗਾ ਅਤੇ ਗਰੀਨ ਡਿਸਟਰਿਕ ਦਾ ਵੀ ਅਵਾਰਡ ਮਿਲਿਆ ਇਹਨੂੰ ਇਸ ਵਾਰ ਬੈਸਟ ਗ੍ਰੀਨ ਡਿਸਟਰਿਕ

ਤੁਹਾਨੂੰ ਕਿਵ ਕਿੰਨਾ ਫ਼ਰਕ ਲੱਗਿਆ ਤੁਹਾਡੇ ਮਾਲਵੇ ਦੇ ਏਰੀਏ ਨਾਲੋਂ ਹਾਂ ਉਹ ਬਿਲਕੁਲ ਬਿਲਕੁਲ ਹੁਸ਼ਿਆਰਪੁਰ ਵਾਟਰ ਲੋਗਿੰਗ ਦਾ ਕਾਰਨ ਇਹ ਹੀ ਹੈ ਸਿਟੀ ਹੈਗੀ ਛੋਟੀ ਥੋੜ੍ਹੀ ਅਤੇ ਇੰਡਸਟਰੀਅਲ ਡਿਵੈਲਪਮੈਂਟ ਥੋੜ੍ਹੀ ਸਲੋਅ ਹੋ ਰਹੀ ਹੈ ਇੱਥੇ ਉਹਦੇ ਕਾਰਨ ਵੀ ਨਾ ਤਾਂ ਜਿਹੜੀ ਓਵਰਆਲ ਡਿਵੈਲਪਮੈਂਟ ਆ ਉਹ ਥੋੜ੍ਹੀ ਸਲੋ ਆ ਤਾਂ ਕਰਕੇ ਵਾਟਰ ਲੋਗਿੰਗ ਵੀ ਇਕ ਵੱਡਾ ਕਾਰਨ ਹਾਂਜੀ ਟਰੈਫਿਕ ਤਾਂ ਬਹੁਤ ਇੰਪੈਕਟਡ ਆ ਅੱਜ ਤੋਂ ਦਸ ਸਾਲ ਪਹਿਲਾਂ ਦਾ ਟਰੈਫਿਕ ਇੱਥੇ ਪਰ ਹੁਣ ਤਾਂ ਇੰਨਾ ਜ਼ਿਆਦਾ ਰੱਸ਼ ਹੋ ਗਿਆ ਕਿ ਨਿਕਲ ਨਹੀਂ ਸਕਦਾ ਬੰਦਾ ਬਿਲਕੁਲ ਜਿੰਨੇ ਬੰਦੇ ਆ ਉੰਨੀਆ ਉੰਨੇ ਵਹੀਕਲਸ ਨੇ ਹੁਸ਼ਿਆਰਪੁਰ ਅਰਬਨ ਫੋਰੈਸਟਰੀ ਨੂੰ ਇਪਰੂਵ ਕਰ ਸਕਦੇ ਮੈਨੂੰ ਲੱਗਦਾ ਹੁਸ਼ਿਆਰਪੁਰ ਉਹਦੇ ਵਿੱਚ ਵਧੀਆ ਕਾਮਯਾਬ ਹੋ ਸਕਦਾ ਹੈ ਕਿਉਂਕਿ ਹੁਸ਼ਿਆਰਪੁਰ ਦੇ ਕਿਸੇ ਵੀ ਘਰ 'ਚ ਚਲ ਜਾਓਂਗੇ ਤੁਹਾਨੂੰ ਹਰੇਕ ਘਰ 'ਚ ਕੋਈ ਨਾ ਕੋਈ ਪੇੜ ਪੌਦੇ ਲੱਗਿਆ ਮਿਲੂਗਾ ਅਤੇ ਇਸ ਚੀਜ਼ ਨੂੰ ਆਪਾਂ ਇੰਪਰੂਵ ਕਰ ਸਕਦੇ ਹਾਂ ਜੇ ਐਡਮੀਸਟ੍ਰੇਟਿਵ ਕੋਈ ਹੋਵੇ ਨਾ ਕਲੋਬਰੇਸ਼ਨ ਤਾਂ ਉਹਦੇ ਨਾਲ ਅਰਬਨ ਫੋਰੈਸਟਰੀ ਨੂੰ ਵਧਾਇਆ ਜਾਣਾ ਚਾਹੀਦਾ ਤਾਂ ਕਿ ਹੁਸ਼ਿਆਰਪੁਰ ਦਾ ਕਲਾਈਮੇਟ ਸਟੇਬਲ ਰਹੇ ਜਿੱਦਾਂ ਪਹਿਲਾ ਸੀਗਾ ਆਉਣ ਵਾਲੇ ਸਮੇਂ 'ਚ ਵੀ ਉੱਦਾਂ ਹੀ ਰਹੇ ਇੰਨਾ ਜ਼ਿਆਦਾ ਬਦਲਾਅ ਨਾ ਹੋਵੇ ਗਲੋਬਲ ਵਾਰਮਿੰਗ ਦੇ ਕਾਰਨ ਇੰਟਰਨੈਸ਼ਨਲ ਲੈਵਲ 'ਤੇ ਵੀ ਬਹੁਤ ਚੇਂਜਜ ਆ ਰਹੇ ਨੇ ਨੂੰ ਕੰਸੀਡਰ ਕਰ ਸਕਦੇ ਹਾਂ ਥੈਂਕ ਯੂ ਜੀ ਥੈਂਕ ਯੂ ਓਕੇ